ਪੰਜਾਬੀ ਇਤਿਹਾਸ ਦੇ ਵਿੱਚ ਵਿਸਾਖੀ ਦੀ ਮਹੱਤਤਾ ਕਾਫੀ ਜ਼ਆਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀ ਗਈ ਅਤੇ ਇਸ ਦੇ ਨਾਲ ਹੀ ਜੋ ਇਹ ਤਿਹਾਰ ਹੈ ਕਿਸਾਨ ਵੀਰਾਂ ਲਈ ਖਾਸ ਮਹੱਤਤਾ ਰੱਖਦਾ ਹੈ ਕਿਉਂਕਿ ਇਸ ਦਿਨ ਜਿਆਦਾਤਰ ਜੋ ਕਿਸਾਨ ਨੇ ਉਹ ਕਣਕ ਦੀ ਵਾਢੀ ਜਾਂ ਤਾਂ ਆਰੰਭ ਕਰ ਦਿੰਦੇ ਹਨ ਜਾਂ ਵਾਢੀ ਚਲ ਰਹੀ ਹੁੰਦੀ ਹੈ ਅਤੇ ਆਪਣੀ ਕਣਕ ਪੱਕਣ ਦੀ ਖੁਸ਼ੀ ਦੇ ਵਿੱਚ ਬੜੇ ਹੋਸ਼ ਉਲਾਸ ਨਾਲ ਇਹ ਤਿਹਾਰ ਨੂੰ ਮਨਾਉਂਦੇ ਹਨ ਸੋ ਬੜੀ ਖੁਸ਼ੀ ਅਤੇ ਚਾਵਾਂ ਦੇ ਨਾਲ ਜਿਆਦਾਤਰ ਕਿਸਾਨ ਵੀਰ ਇਸ ਤਿਹਾਰ ਨੂੰ ਮਨਾਉਂਦੇ ਨੇ ਪਿੰਡ ਵਿੱਚ ਕਿਸੇ ਇੱਕ ਖਾਸ ਜਗ੍ਹਾ ਦੇ ਉੱਤੇ ਸਾਂਝੀ ਥਾਂ ਦੇ ਉੱਤੇ ਇਹ ਮੇਲਾ ਜੋ ਹੈ ਮਨਾਇਆ ਜਾਂਦਾ ਹੈ ਅਤੇ ਇਸ ਬਾਰੇ ਇਸ਼ਤਿਹਾਰ ਬਾਰੇ ਇੱਕ ਕਵਿਤਾ ਨੇ ਬੜੀ ਸੋਹਣੀ ਕਵਿਤਾ ਵੀ ਲਿਖੀ ਹੈ ਕਿ ਮਾਰਦਾ ਦਮਾਮੇ ਜੱਟ ਮੇਲਿਆ ਗਿਆ ਤਾਂ ਇਸ ਵਿਸਾਖੀ ਦੇ ਤਿਉਹਾਰ ਨੂੰ ਦਰਸਾਉਂਦੀ ਹੈ ਕਵਿਤਾ ਬੜੇ ਹੀ ਸੁੰਦਰ ਸ਼ਬਦਾਂ ਦੇ ਵਿੱਚ ਕਵੀ ਦੁਆਰਾ ਜੋ ਹੈ ਵਰਨਿਤ ਕੀਤੀ ਗਈ ਹੈ ਸੋ ਫਸਲਾਂ ਪੱਕਣ ਦੀ ਖੁਸ਼ੀ ਦੇ ਵਿੱਚ ਕਣਕ ਪੱਕਣ ਦੀ ਖੁਸ਼ੀ ਦੇ ਵਿੱਚ ਜੋ ਇਹ ਤਿਹਾਰ ਹੈ ਮਨਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਪੁਰਾਣਾ ਇਤਿਹਾਸ ਖਾਲਸਾ ਪੰਥ ਦੀ ਸਾਜਨਾ ਜੋ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਈ ਸੀ ਉਸ ਬਾਰੇ ਵੀ ਸਾਨੂੰ ਇਹ ਇਤਿਹਾਸ ਯਾਦ ਕਰਵਾਉਂਦਾ ਹੈ ਸੋ ਲੋਕ ਨਵੇਂ ਕੱਪੜੇ ਪਾ ਕੇ ਸੱਜ ਧੱਜ ਕੇ ਇਸ ਦਿਨ ਮੇਲਿਆਂ ਦੇ ਵਿੱਚ ਜਾਂਦੇ ਨੇ ਤੇ ਆਪਣੀ ਖੁਸ਼ੀ ਦਾ ਜੋ ਹੈ ਇਜ਼ਹਾਰ ਕਰਦੇ ਨੇ ਧੰਨਵਾਦ